ਬੱਚੇ ਅੱਜ ਕੱਲ੍ਹ ਟੀ ਵੀ ਛੱਡ ਕੇ ਮੋਬਾਈਲਾਂ ਵੱਲ ਸ਼ੁਰੂ ਹੋ ਗਏ ਨੇ ਮੋਬਾਈਲਾਂ ਉੱਤੇ ਗੇਮਾਂ ਖੇਲਣੀਆਂ ਜਿਵੇਂ ਮੰਨ ਲਉ ਪਬਜੀ ਹੋ ਗਈ ਪਬਜੀ ਦੇ ਟਾਸਕ ਪੂਰਾ ਕਰਦੇ ਕਰਦੇ ਆਪਣੀ ਜਵਾਨ ਜਾਨ ਗਵਾ ਲੈਂਦੇ ਹਨ ਅਤੇ ਇਹਦੇ ਵਿੱਚ ਬਹੁਤ ਨੁਕਸਾਨ ਹੁੰਦਾ ਹਨ ਕਈ ਅਕਾਊਂਟ ਵਿੱਚ ਲੱਗ ਵਿੱਚ ਪੈਸੇ ਕੱਟ ਹੋ ਜਾਂਦੇ ਨੇ ਪੈਸੇ ਕੱਟ ਹੋਣ ਕਰਕੇ ਫਿਰ ਬੱਚਿਆਂ ਨੂੰ ਵੀ ਗਾਲ੍ਹਾਂ ਪੈਂਦੀਆਂ ਹਨ ਜਦਕਿ ਟੀ ਵੀ ਛੱਡ ਕੇ ਮੋਬਾਈਲਾਂ ਵੱਲ ਸ਼ੁਰੂ ਹੋ ਗਏ ਜੋ ਕਿ ਮੋਬਾਇਲ ਗੇਮਾਂ ਸਹੀ ਹੈ ਟੀ ਵੀ ਕੁਛ ਨਹੀਂ ਦੇਖਣਾ ਮੋਬਾਈਲਾਂ ਕਰਕੇ ਬੱਚੇ ਨਿਗ੍ਹਾ ਨੂੰ ਬਹੁਤ ਪ੍ਰੋਬਲਮ ਆ ਗਈ ਅਤੇ ਹੁਣ ਹਰ ਇੱਕ ਬੱਚੇ ਦੇ ਸਪੈਕਸ ਐਨਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਕਦੇ ਪਹਿਲਾਂ ਟਾਈਮ ਚੰਗਾ ਹੁੰਦਾ ਸੀ ਵੀ ਸਿਆਣੇ ਬਿਆਣੇ ਪਹਿਲਾਂ ਟਾਈਮ ਸਿਆਣੇ ਕੋਲ ਫੋਨ ਨਹੀਂ ਤੇ ਟੀ ਵੀ ਤਾ ਟੀ ਵੀ ਤਾ ਟੀ ਵੀ ਅਤੇ ਸਹੀ ਹੈ ਆਪਣਾ ਹਰ ਸਭ ਇਕੱਠੇ ਹੋ ਕੇ ਬੈਠਣਾ ਘੰਟਾ ਲਾ ਕੇ ਦੇਖ ਲੈਣਾ ਘੰਟਾ ਲਾ ਕੇ ਦੇਖ ਕੇ ਉਹਦੇ ਵਿੱਚ ਦੇਖ ਲੈਣਾ ਕਿੱਦਾਂ